ਹਾਂਜੀ ਮੈਂ ਅੰਮ੍ਰਿਤਸਰ ਸ਼ਹਿਰ ਦੀ ਰਹਿਣ ਵਾਲੀ ਹਾਂ ਜਿਹਨੂੰ ਕਿ ਗੁਰੂ ਦੀ ਨਗਰੀ ਵੀ ਕਿਹਾ ਜਾਂਦਾ ਹੈ ਮੇਰਾ ਸ਼ਹਿਰ ਬਹੁਤ ਹੀ ਪਵਿੱਤਰ ਹੈ ਕਿਉਂਕਿ ਮੇਰੇ ਸ਼ਹਿਰ ਦੇ ਵਿੱਚ ਰਾਮ ਤੀਰਥ ਰਾਮ ਜੀ ਦੇ ਯੁੱਗ ਦਾ ਭਗਵਾਨ ਵਾਲਮੀਕੀ ਜੀ ਦੀ ਕੁਟੀਆ ਜਿਹਦੇ ਵਿੱਚ ਲਵ ਕੁਸ਼ ਪੈਦਾ ਹੋਏ ਸਨ ਵਸਦਾ ਹੈ ਮੇਰੇ ਸ਼ਹਿਰ ਵਿੱਚ ਗੋਲਡਨ ਟੈਂਪਲ ਹੈ ਜੋ ਕਿ ਸਿੱਖਾਂ ਦਾ ਸਭ ਤੋਂ ਵੱਡਾ ਗੁਰਦੁਆਰਾ ਹੈ ਜਿਹਦੇ ਵਿੱਚ ਸਿੱਖ ਧਰਮ ਦੀ ਨੀਂਹ ਰੱਖੀ ਗਈ ਸੀ ਮੇਰੇ ਸ਼ਹਿਰ ਵਿੱਚ ਦੁਰਗਿਆਣਾ ਮੰਦਿਰ ਹੈ ਮਾਡਲ ਟਾਊਨ ਅਤੇ ਹੋਰ ਵੀ ਵੱਖ ਵੱਖ ਆਕਰਸ਼ਣ ਯੋਗ ਚੀਜ਼ਾਂ ਹਨ ਆਕਰਸ਼ਣ ਯੋਗ ਚੀਜ਼ਾਂ ਤਾਂ ਹੋਰ ਵੀ ਹਨ ਜਿਵੇਂ ਕਿ ਜਲ੍ਹਿਆਵਾਲਾ ਬਾਗ ਮਗਰ ਭਾਈਚਾਰੇ ਨੂੰ ਵਧਾਉਣ ਵਾਲੇ ਚੀਜ਼ਾਂ ਨੇ ਗੁਰਦੁਆਰੇ ਮੰਦਿਰ ਕਿਉਂਕਿ ਮੈਂ ਆਪਣੀ ਅੱਖੀਂ ਦੇਖਦੀ ਹਾਂ ਕਿ ਦਰਬਾਰ ਸਾਹਿਬ ਦੇ ਵਿੱਚ ਰੋਜ਼ ਹੀ ਹਜ਼ਾਰਾਂ ਦੀ ਸੰਖਿਆ ਵਿੱਚ ਲੋਕ ਦਰਸ਼ਨ ਕਰਨ ਆਉਂਦੇ ਨੇ ਅਤੇ ਵੱਖ ਵੱਖ ਥਾਵਾਂ ਤੋਂ ਆਉਂਦੇ ਨੇ ਕੋਈ ਦਿੱਲੀ ਤੋਂ ਕੋਈ ਬਾਹਰੋਂ ਕੋਈ ਕੈਨੇਡਾ ਤੋਂ ਕੋਈ ਸਾਊਥ ਤੋਂ ਉੱਥੇ ਧਰਮ ਦਾ ਨਹੀਂ ਦੇਖਿਆ ਜਾਂਦਾ ਉੱਥੇ ਰੋਜ਼ ਹੀ ਕੋਈ ਉਸ ਦਰ ਤੋਂ ਕੋਈ ਭੁੱਖਾ ਨਹੀਂ ਜਾਂਦਾ ਰੋਜ਼ ਹੀ ਹਜ਼ਾਰਾਂ ਦੇ ਹਿਸਾਬ ਲੋਕਾਂ ਦੇ ਹਿਸਾਬ ਨਾਲ ਲੰਗਰ ਵਰਤਾਇਆ ਜਾਂਦਾ ਹੈ ਅਤੇ ਜੋ ਵੀ ਉੱਥੇ ਸੇਵਾ ਕਰਨਾ ਚਾਹਵੇ ਉਹ ਕਰ ਸਕਦਾ ਹੈ ਕਿਸੇ ਦੇ ਉੱਤੇ ਕੋਈ ਪਾਬੰਦੀ ਨਹੀਂ ਹੈ ਉੱਥੇ ਧਰਮ ਨਹੀਂ ਦੇਖਿਆ ਜਾਂਦਾ ਬਲਕਿ ਭਾਵਨਾ ਦੇਖੀ ਜਾਂਦੀ ਹੈ ਇਹ ਚੀਜ਼ਾਂ ਸਾਨੂੰ ਇੱਕ ਦੂਜੇ ਦੇ ਪ੍ਰਤੀ ਭਾਈਚਾਰਾ ਵਧਾਉਣ ਦੇ ਵਿੱਚ ਬਹੁਤ ਮੱਦਦ ਕਰਦੀਆਂ ਹਨ ਧੰਨਵਾਦ